ਪੰਜਾਬ ਦੇ ਵਿੱਚ ਹੁਣ ਵਿਕਾਸ ਬੜੇ ਸਿਖਰਾਂ 'ਤੇ ਹੋ ਰਿਹਾ ਹੈ ਜ਼ਿਆਦਾਤਰ ਵਿਕਾਸ ਉਹ ਸੜਕਾਂ ਦੇ ਨਿਰਮਾਣ ਵਿੱਚ ਹੋ ਰਿਹਾ ਹੈ ਮੈਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਬੜੇ ਵੱਡੇ ਵੱਡੇ ਜਿਹੜੇ ਪੁਲ ਆ ਉਸਾਰੇ ਜਾ ਰਹੇ ਆ ਚਾਹੇ ਉਹ ਅੰਡਰ ਬ੍ਰਿਜ ਹੋਣ ਚਾਹੇ ਓਵਰ ਬ੍ਰਿਜ ਹੋਣ ਉਹਨਾਂ ਦੀ ਲਗਾਤਾਰ ਜਿਹੜੀ ਗਿਣਤੀ ਉਹ ਵੱਧ ਰਹੀ ਹੈ ਜਿਸ ਦੇ ਨਾਲ ਆਉਣ ਜਾਣ ਆਵਾਜਾਈ ਬੜੀ ਸੁਖਾਲੀ ਹੋ ਚੁੱਕੀ ਹੈ ਇਸ ਕਰਕੇ ਹੁਣ ਉਸਨੇ ਬੜਾ ਸਾਡੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਮੇਰੇ ਜੀਵਨ ਦੇ ਵਿੱਚ ਸਭ ਤੋਂ ਵੱਡੀ ਘਟਨਾ ਜਿਹੜੀ ਵਾਪਰੀ ਉਹ ਕੋਰੋਨਾ ਦਾ ਅਚਾਨਕ ਆ ਜਾਣਾ ਅਤੇ ਲਾਕਡਾਊਨ ਦਾ ਲੱਗ ਜਾਣਾ ਉਸ ਸਮੇਂ ਵਿੱਚ ਜੀਵਨ ਬਿਲਕੁਲ ਪ੍ਰਭਾਵਿਤ ਹੋ ਗਿਆ ਸੀ ਜਿਸ ਨੇ ਇੱਕ ਵਿਸ਼ੇਸ਼ ਭਾਈਚਾਰੇ ਜੋ ਪ੍ਰਵਾਸੀ ਮਜ਼ਦੂਰ ਇੱਧਰ ਆਏ ਸੀ ਉਹਨਾਂ ਨੂੰ ਬੜਾ ਪ੍ਰਭਾਵਿਤ ਕੀਤਾ ਕਿਉਂਕਿ ਉਹਨਾਂ ਕੋਲ ਰਹਿਣ ਦੀ ਇੱਥੇ ਆਪਣੇ ਪੱਕੇ ਟਿਕਾਣੇ ਨਹੀਂ ਸੀ ਅਤੇ ਉਹਨਾਂ ਨੂੰ ਲਾਕਡਾਊਨ ਦੇ ਦੌਰਾਨ ਜਦੋਂ ਸਭ ਕੁਝ ਬੰਦ ਸੀ ਆਪਣੇ ਘਰਾਂ ਨੂੰ ਵਾਪਿਸ ਪਰਤਣਾ ਪਿਆ ਇਹ ਬੜਾ ਮੁਸ਼ਕਿਲ ਮੁਸ਼ਕਿਲ ਸਮਾਂ ਸੀ ਜੋ ਲੰਘ ਗਿਆ